ਮੇਰਾ ਸੰਬੰਧ ਮੌਸਲੀ ਪੰਜਾਬੀ ਲੈਂਗੁਏਜ ਦੇ ਨਾਲ ਹੈ ਤਾਂ ਮੈਨੂੰ ਕੁਛ ਵੀ ਅੱਗੇ ਪੰਜਾਬੀ ਪੰਜਾਬ ਜਾਂ ਪੰਜਾਬੀ ਦੇ ਬਾਰੇ ਤੁਸੀਂ ਪੁੱਛ ਸਕਦੇ ਹੋ